ਸੱਭਿਆਚਾਰ ਨੂੰ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਾਹਰੀ ਸੱਭਿਆਚਾਰ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੁੰਦਾ ਸੀਗਾ ਜਿਵੇਂ ਕਿ ਮੰਨ ਲਓ ਕਣਕ ਕਣਕ ਦੀ ਕਟਾਈ ਹੁੰਦੀ ਸੀਗੀ ਅਤੇ ਲੋਕ ਖੁਸ਼ੀ ਵਿੱਚ ਕਣਕ ਦੀ ਕਟਾਈ ਦੀ ਖੁਸ਼ੀ ਵਿੱਚ ਭੰਗੜਾ ਪਾਉਂਦੇ ਸੀਗੇ ਲੁੱਡੀਆਂ ਪਾਉਂਦੇ ਸੀਗੇ ਨੱਚਦੇ ਟੱਪਦੇ ਸੀ ਜਿਵੇਂ ਕੋਈ ਤਿਉਹਾਰ ਆ ਜਾਂਦਾ ਸੀ ਜਿਵੇਂ ਕਿ ਲੋਹੜੀ ਦਾ ਤਿਉਹਾਰ ਕੁੜੀਆਂ ਲੋਹੜੀ ਬਾਲ਼ ਕੇ ਉਹਦੇ ਆਲ਼ੇ ਦੁਆਲ਼ੇ ਨੱਚਦੀਆਂ ਸੀਗੀਆਂ ਜਿਵੇਂ ਸਾਉਣ ਦਾ ਮਹੀਨਾ ਹੋ ਗਿਆ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦੇ ਮੇਲੇ ਲੱਗਦੇ ਹਨ ਕੁੜੀਆਂ ਦੁਆਰਾ ਗਿੱਧਾ ਪਾਇਆ ਜਾਂਦਾ ਭੰਗੜੇ ਪਾਏ ਜਾਂਦੇ ਹਨ ਅਤੇ ਇਹ ਸਾਰਾ ਇੱਕ ਸੱਭਿਆਚਾਰ ਦਾ ਹਿੱਸਾ ਹੈ ਜੋ ਕਿ ਸਾਡੇ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਏ ਕਿ ਸਾਡਾ ਸੱਭਿਆਚਾਰ ਕਿੰਨਾ ਮਹਾਨ ਹੈ ਅਤੇ ਸਾਨੂੰ ਇਸਨੂੰ ਸਾਂਭ ਕੇ ਰੱਖਣ ਦੀ ਕਿੰਨੀ ਜ਼ਰੂਰਤ ਹੈ ਪਰ ਜਿਉਂ ਜਿਉਂ ਸਮਾਂ ਬਦਲਿਆ ਜਿਵੇਂ ਜਿਵੇਂ ਆਧੁਨਿਕੀਕਰਨ ਹੋਇਆ ਸਾਡੇ ਸੱਭਿਆਚਾਰ ਉੱਤੇ ਬਾਹਰੀ ਸੱਭਿਆਚਾਰ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਨਾ ਕਿ ਇਹ ਜਿੰਨੇ ਵੀ ਆਪਣੇ ਲੋਕ ਨਾਚ ਹੈ ਲੁੱਡੀ ਹੋ ਗਿਆ ਸੰਮੀ ਹੋ ਗਿਆ ਭੰਗੜਾ ਗਿੱਧਾ ਖਤਮ ਹੀ ਹੁੰਦਾ ਜਾ ਰਿਹਾ ਇਸਦੀ ਇਸਦੀ ਜਗ੍ਹਾ ਡੀ ਜੇ ਨੇ ਲੈ ਲਈ ਹੈ ਅਤੇ ਅੱਜ ਕੱਲ੍ਹ ਤੀਆਂ ਵੀ ਕਿਸੇ ਮੋਲ ਦੇ ਵਿੱਚ ਲੱਗਦੀਆਂ ਕਿਸੇ ਰੈਸਟੋਰੈਂਟ ਦੇ ਵਿੱਚ ਲੱਗਦੀਆਂ ਉੱਥੇ ਡੀ ਜੇ ਚਲਾ ਦਿੱਤੇ ਜਾਂਦੇ ਹਨ ਅਤੇ ਤੀਆਂ ਮਨਾ ਲਈਆਂ ਜਾਂਦੀਆਂ ਹਨ ਅਤੇ ਇਵੇਂ ਹੀ ਲੋਹੜੀ ਦਾ ਤਿਉਹਾਰ ਹੈ ਲੋਹੜੀ ਬਾਲ਼ ਲੋਹੜੀ ਬਾਲ਼ ਲਈ ਜਾਂਦੀ ਹੈ ਅਤੇ ਡੀ ਜੇ ਲਗਾ ਕੇ ਬਸ ਉਥੇ ਨੱਚਿਆ ਟੱਪਿਆ ਜਾਂਦਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਨ ਕਿ ਆਰਟੀਫਿਸ਼ਅਲ ਹੈ ਬਨਾਵਟੀ ਚੀਜ਼ਾਂ ਦਾ ਰੂਪ ਧਾਰਨ ਕਰ ਗਿਆ ਏ ਅਤੇ ਜਿਹੜਾ ਆਪਣਾ ਅਸਲੀ ਸੱਭਿਆਚਾਰ ਹੈ ਅਸਲੀ ਜਿਹੜੇ ਆਪਣੇ ਲੋਕ ਨਾਚ ਸੀਗੇ ਉਹ ਕਿਤੇ ਨਾ ਕਿਤੇ ਅਲੋਪ ਹੋ ਗਏ ਹਨ ਅਤੇ ਅਲੋਪ ਹੋ ਰਹੇ ਹਨ ਅਤੇ ਸਾਨੂੰ ਲੋੜ ਹੈ ਕਿ ਅਸੀਂ ਇਹਨਾਂ ਨੂੰ ਸਾਂਭ ਕੇ ਰੱਖੀਏ